ਮੈਂ ਪਿੰਡ ਮਾਨਾਂ ਵਾਲੇ ਦਾ ਰਹਿਣ ਵਾਲਾ ਹਾਂ ਜਿੱਥੇ ਕਿ ਸਾਡੇ ਪਿੰਡ ਵਿੱਚ ਇੱਕ ਸਰਕਾਰੀ ਹੋਸਪੀਟਲ ਹੈ ਜਿਸ ਨੂੰ ਸੱਤ ਅੱਠ ਪਿੰਡ ਲਾਗੇ ਲਾਗੇ ਸਾਰੇ ਹੀ ਉਸ ਸਰਕਾਰੀ ਹੋਸਪੀਟਲ ਵਿੱਚ ਆਉਂਦੇ ਹਨ ਵੈਕਸੀਨ ਦਵਾਈਆਂ ਵਗੈਰਾ ਹਰ ਇੱਕ ਚੀਜ਼ ਸੱਤ ਅੱਠ ਪਿੰਡਾਂ ਦੇ ਮਤਲਬ ਹੋਣ ਕਾਰਣ ਜ਼ਿਆਦਾ ਭੀੜ ਹੋਣ ਕਾਰਣ ਕਈ ਵਾਰ ਸਾਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਬੈੱਡ ਬੈੱਡ ਹਾਂ ਜਾਂ ਵਾਰਡ ਨਹੀਂ ਪ੍ਰਾਪਤ ਹੁੰਦੇ ਜ਼ਿਆਦਾ ਭੀੜ ਹੋਣ ਕਾਰਨ ਡਾਕਟਰ ਹਨ ਚੰਗੇ ਡਾਕਟਰ ਵੀ ਹਨ ਬਟ ਕੁਝ ਕਮੀਆਂ ਕਮੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜ਼ਿਆਦਾ ਭੀੜ ਹੋਣ ਕਾਰਣ ਇਸ ਕਰਕੇ ਨੇੜਲੇ ਕਸਬੇ ਜਿੰਨੇ ਵੀ ਹਨ ਉਸ ਹੋਸਪਿਟਲ ਵਿੱਚ ਆਉਂਦੇ ਹਨ ਜੋ ਕਿ ਹੋਰ ਦੂਰ ਦੂਰ ਹੋਸਪਿਟਲ ਹਨ ਉੱਥੇ ਜਾਣ ਵਿੱਚ ਸਾਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਹੋਸਪਿਟਲ ਵਿੱਚ ਡਾਕਟਰ ਵੀ ਬਹੁਤ ਹਨ ਹਾਈਜੈਨਿਕ ਵਧੀਆ ਡਾਕਟਰ ਹਨ ਵੈਕਸੀਨ ਵਗੈਰਾ ਹਰ ਇੱਕ ਚੀਜ਼ ਵੀ ਹੈ ਬਟ ਸਾਨੂੰ ਕਮੀਆਂ ਦਾ ਦਿੱਕਤਾਂ ਦਾ ਸਾਹਮਣਾ ਕਰਨ ਕਰਨਾ ਪੈਂਦਾ ਹੈ ਇਸ ਕਰਕੇ ਇਸ ਨੂੰ ਥੋੜ੍ਹਾ ਵੱਡਾ ਕੀਤਾ ਜਾਵੇ ਡਾਕਟਰਾਂ ਦਾ ਪ੍ਰਬੰਧ ਵੀ ਕੀਤਾ ਜਾਵੇ ਅਤੇ ਜੋ ਕਿ ਹੋਰ ਦਵਾਈਆਂ ਵੈਕਸੀਨ ਵਗੈਰਾ ਹਰ ਇੱਕ ਚੀਜ਼ ਦਾ ਪ੍ਰਬੰਧ ਕੀਤਾ ਜਾਵੇ ਸਾਨੂੰ ਕਿਸੇ ਚੀਜ਼ ਦੀ ਪ੍ਰੋਬਲਮ ਨਾ ਆਵੇ ਅਸੀਂ ਆਪਣੇ ਨੇੜਲੇ ਹੀ ਹੋਸਪਿਟਲ ਵਿੱਚ ਆਪਣਾ ਇਲਾਜ ਕਰਵਾਈਏ